ਵੈਸੇ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਭਾਈਚਾਰਕ ਸਾਂਝ ਰਹਿੰਦੀ ਹੈ ਪਰ ਕਈ ਵੀ ਕੀ ਹੁੰਦਾ ਹੈ ਆਪਣੇ ਵਿਚਾਰਕ ਮਤਭੇਦਾਂ ਦੇ ਕਾਰਨ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਉਹ ਵੱਢ ਟੁੱਕ ਤੱਕ ਪਹੁੰਚ ਜਾਂਦੇ ਹਨ ਜਿਹਦੇ ਨਾਲ ਇੱਕ ਵਿਅਕਤੀ ਦੂਜੇ ਵਿਅਕਤੀ ਦਾ ਕੋਈ ਅੰਗ ਤੋੜ ਦਿੰਦਾ ਹੈ ਅਤੇ ਉਸ ਤੋਂ ਅੱਗੇ ਜੋ ਅੰਗ ਤੋੜ ਦਿੰਦਾ ਹੈ ਤਾਂ ਉਸ ਦੀ ਜਿਹੜੀ ਰਿਕਵਰੀ ਪ੍ਰਕਿਰਿਆ ਉਹ ਇਸ ਤਰ੍ਹਾਂ ਹੁੰਦੀ ਹੈ ਵੀ ਕਈ ਵਾਰ ਪਿੰਡ ਦੇ ਹਸਪਤਾਲ ਦੇ ਵਿੱਚ ਉਹ ਰਿਕਵਰੀ ਹੁੰਦੀ ਹੈ ਜਾਂ ਕਈ ਵਾਰ ਉਹ ਆਪਣੇ ਪਿੰਡ ਦੇ ਹੀ ਕਿਸੇ ਵੈਦ ਨੂੰ ਕਿਸੇ ਸਿਆਣੇ ਬੰਦੇ ਨੂੰ ਜਾਂ ਘਰੇਲੂ ਨੁਸਕਿਆਂ ਰਾਹੀਂ ਉਹ ਰਿਕਵਰੀ ਕੀਤੀ ਜਾਂਦੀ ਹੈ ਪਰ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਇਹ ਰਿਕਵਰੀ ਹਸਤਾਲਾਂ ਦੇ ਵਿੱਚ ਜਿਵੇਂ ਕਹਿ ਦਈਏ ਆਪਾਂ ਕਿਸੇ ਦਿਨ ਬਾਂਹ ਤੋੜਤੀ ਜਾਂ ਲੱਤ ਤੋੜਤੀ ਉਸ ਦਾ ਪਲਸਤਰ ਕ ਕੀਤਾ ਜਾਂਦਾ ਹੈ ਅਤੇ ਇਹਦਾ ਇਲਾਜ ਹੈ ਉਹ ਸਰਕਾਰੀ ਹਸਤਾਲਾਂ ਦੇ ਵਿੱਚ ਕਰਵਾਇਆ ਜਾਂਦਾ ਹੈ ਜਿਹਦੇ ਨਾਲ ਬ ਜਿਹੜਾ ਬੰਦਾ ਹੁੰਦਾ ਉਹ ਵਧੀਆ ਤਰੀਕੇ ਦੇ ਨਾਲ ਰਿਕਵਰੀ ਕਰ ਲੈਂਦਾ ਹੈ ਉਸ ਦਾ ਜਿਹੜੇ ਖਾਣ ਪੀਣ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਹੈ ਉਸ ਨੂੰ ਚੰਗੀ ਡਾਈਟ ਦਿੱਤੀ ਜਾਂਦੀ ਹੈ ਉਸ ਦੇ ਚੱਲਣ ਫਿਰਨ ਦੇ ਲਈ ਜਿਹੜੇ ਕਿ ਹੈ ਵੱਖ ਵੱਖ ਤਰ੍ਹਾਂ ਦੇ ਵਿਸਾਖੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੇਕਰ ਇਸ ਤਰ੍ਹਾਂ ਹੁੰਦਾ ਰਹੇ ਤਾਂ ਜਿਹੜੀ ਰਿਕਵਰੀ ਆ ਉਹ ਜਲਦੀ ਹੀ ਹੋ ਜਾਂਦੀ ਹੈ ਅਤੇ ਜਿਹੜੇ ਵਿਅਕਤੀ ਹੈ ਉਹ ਜਲਦੀ ਹੀ ਤੰਦਰੁਸਤ ਹੋ ਕੇ ਆਪਣੇ ਕੰਮਾਂ ਦੇ ਉੱਤੇ ਕੰਮ ਦੇ ਉੱਤੇ ਜਾਣ ਲਈ ਤਿਆਰ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਸ ਭਾਈਚਾਰਕ ਸਾਂਝ ਤਾਂ ਵੈਸੇ ਰਹਿੰਦੀ ਹੈ ਪਰ ਕਈ ਵਾਰ ਮਤਭੇਦ ਹੋਣ ਕਰਕੇ ਲੜਾਈ ਝਗੜਾ ਹੋ ਜਾਂਦਾ ਹੈ ਅਤੇ ਤੂੰ ਤੂੰ ਮੈਂ ਮੈਂ ਵੀ ਹੋ ਜਾਂਦੀ ਹੈ ਪਰ ਤੂੰ ਤੂੰ ਮੈਂ ਮੈਂ ਕਈ ਵਾਰ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਹ ਲੱਤ ਬ ਲੱਤ ਬਾਂਹ ਜਾਂ ਜਿਵੇਂ ਕਹਿ ਦਈਏ ਵੀ ਤੋੜ ਦਿੰਦੇ ਨੇ ਇੱਕ ਦੂਜੇ ਦੀ ਉਹ ਤਾਂ ਇਸ ਤਰੀਕੇ ਦੇ ਨਾਲ ਉਹ ਜਿਹੜਾ ਕੀ ਹੈ ਫਿਰ ਇਲਾਜ ਕਰਵਾਇਆ ਜਾਂਦਾ ਹੈ ਉਹ ਘਰੇਲੂ ਵੀ ਹੋ ਸਕਦਾ ਹੈ ਇਹ ਪਿੰਡ ਦੇ ਹਸਤਾਲ 'ਚ ਹੋ ਸਕਦਾ ਹੈ ਜਾਂ ਫਿਰ ਸ਼ਹਿਰ ਦੇ ਵਿੱਚ ਲਿਜਾ ਕੇ ਮਹਿੰਗੇ ਹਸਪਤਾਲਾਂ ਦੇ ਵਿੱਚ ਵੀ ਉਸਦਾ ਇਲਾਜ ਕਰਵਾਇਆ ਜਾਂਦਾ ਹੈ ਜਿਹਦੇ ਵਿੱਚ ਲੱਤ ਜਾਂ ਬਾਂਹ ਟੁੱਟਣ ਦੇ ਨਾਲ ਉਸਨੂੰ ਪਲਸਤਰ ਲਗਾਇਆ ਜਾਂਦਾ ਹੈ ਪਲਸਤਰ ਦੇ ਨਾਲ ਇਹਦੀ ਲੱਤ ਜਾਂ ਬਾਂਹ ਉਹ ਜਲਦੀ ਜੁੜ ਜਾਂਦੀ ਹੈ ਅਤੇ ਉਸ ਬੰਦੇ ਨੂੰ ਤੰਦਰੁਸਤ ਕਰਕੇ ਸਹੀ ਸਲਾਮਤ ਘਰ ਭੇਜਿਆ ਜਾਂਦਾ ਹੈ ਜਿਹਦੇ ਨਾਲ ਉਹ ਅੱਗੇ ਆਪਣੇ ਕੰਮ ਕਾਰਾਂ ਦੇ ਉੱਤੇ ਜਾਣ ਦੇ ਲਈ ਤਿਆਰ ਹੋ ਜਾਂਦਾ ਹੈ